ਬੱਚੇ ਆਪਣੇ ਘਰ ਵਿੱਚ ਬੈਠੇ ਹੀ ਆਪਣੀ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਜਿਨ੍ਹਾਂ ਬੱਚਿਆਂ ਦੇ ਘਰ ਸ਼ਹਿਰਾਂ ਤੋਂ ਦੂਰ ਹਨ ਉਹ ਵੀ ਪੜ੍ਹਾਈ ਕਰ ਸਕਦੇ ਹਨ ਕਿਉਂਕਿ ਉਹਨਾਂ ਦੇ ਘਰਾਂ ਤੋਂ ਆਵਾਜਾਈ ਦੀ ਸੁਵਿਧਾ ਨਹੀਂ ਹੁੰਦੀ ਨਿਊਜ਼ ਮੀਡੀਆ ਦੀ ਮਦਦ ਨਾਲ ਉਹ ਚੰਗੀ ਨੌਕਰੀਆਂ ਲੈ ਸਕਦੇ ਹਨ